ਹੈਲੋ ਸਤਿ ਸ਼੍ਰੀ ਅਕਾਲ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਹੁਣ ਤਾਂ ਮੈਂ ਪੜ੍ਹਨ ਗਿਆ ਉੱਥੇ ਪਹਿਲਾਂ ਪੜ੍ਹਦਾ ਸੀਗਾ ਠੀਕ ਹੈ ਠੀਕ ਹੈ ਮਹਾਰਾਜ ਦੱਸੋ ਕਿਵੇਂ ਹੈਲਪ ਕਰ ਸਕਦੇ ਹਾਂ ਆਪਾਂ ਤੁਹਾਡੀ ਦੇਖੋ ਟੈਂਮਰੇਚਰ ਦੀ ਗੱਲ ਤਾਂ ਇੱਦਾਂ ਹੈ ਵੀ ਪੂਰੇ ਪੰਜਾਬ ਨਾਲ ਰਲਦਾ ਮਿਲਦਾ ਹੀ ਹੈ ਜਿਹੜਾ ਇਹ ਕਪੂਰਥਲਾ ਹੈ ਪੈਂਦਾ ਜੀ ਤੁਹਾਡਾ ਦੁਆਬੇ ਦੀ ਧਰਤੀ ਦੇ ਉੱਤੇ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਉਹ ਸਾਡੇ ਬਹੁਤ ਜ਼ਿਆਦਾ ਨਜ਼ਦੀਕ ਪੈਂਦਾ ਉਹ ਨਜ਼ਦੀਕ ਪੈਣ ਦੇ ਕਰਕੇ ਕਿਆ ਹੁੰਦਾ ਇੱਥੇ ਦਾ ਜਿਹੜਾ ਕਲਾਈਮੇਟ ਹੈ ਇੱਥੇ ਇੱਕ ਤਾਂ ਜਿਹੜੀ ਮੌਨਸੂਨ ਹੈ ਉਹ ਲੇਟ ਪਹੁੰਚਦੀ ਬਰਸਾਤਾਂ ਦੇ ਮੌਸਮ ਵਿੱਚ ਠੀਕ ਹੈ ਮੀਂਹ ਵੀ ਇੱਥੇ ਠੀਕ ਠਾਕ ਰਹਿੰਦਾ ਐਵੇਂ ਕਹਿ ਦਈਏ ਵੀ ਬਹੁਤ ਜ਼ਿਆਦਾ ਜ਼ਿਆਦਾ ਨਹੀਂ ਵਰਖਾਂ ਵੀ ਇੱਥੇ ਨੋਰਮਲ ਰਹਿੰਦੀ ਪਰ ਠੰਢਾਂ ਵਿੱਚ ਠੰਢ ਜ਼ਿਆਦਾ ਗਰਮੀਆਂ ਵਿੱਚ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਪੈਂਦੀ ਵੀਰੇ ਹਾਂ ਵੈਸੇ ਓਵਰ ਆਲ ਜੇ ਆਪਾਂ ਗੱਲ ਕਰ ਲਈਏ ਤਾਂ ਕਲਾਈਮੇਟ ਜਿਹੜਾ ਉਹ ਹੋਰ ਸਟੇਟਾਂ ਦੇ ਮੁਕਾਬਲੇ ਵਿੱਚ ਜਿਵੇਂ ਪੰਜਾਬ ਸਟੇਟ ਦਾ ਜਿਹੜਾ ਕਲਾਈਮੇਟ ਹੈ ਉਸ ਢੰਗ ਦਾ ਕਲਾਈਮੇਟ ਇੱਥੇ ਰਹਿੰਦਾ ਕਪੂਰਥਲੇ ਦੇ ਵਿੱਚ ਕਪੂਰਥਲੇ ਵਿੱਚ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ ਤਿੰਨ ਦਰਿਆ ਹੈ ਜਿਹੜੇ ਚੱਲਦੇ ਹੈ

ਇਹ ਇੱਕ ਸਤਲੁਜ ਹੋ ਗਿਆ ਇੱਕ ਬਿਆਸ ਹੋ ਗਿਆ ਇੱਕ ਰਾਵੀ ਹੋ ਗਿਆ ਬਿਆਸ ਸਤਲੁਜ ਔਰ ਜਿਹੜਾ ਇੱਕ ਤੁਹਾਡਾ ਰਾਵੀ ਨਹੀਂ ਰਾਵੀ ਤਾਂ ਆਪਣਾ ਅੱਧਾ ਚੱਲਦਾ ਹੈ ਇੱਕ ਬਿਆਸ ਹੈ ਇੱਕ ਸਤਲੁਜ ਹੈ ਇੱਕ ਤੁਹਾਡਾ ਦੂਜਾ ਹੈ ਆਪਣਾ ਇੱਥੋਂ ਆਉਂਦਾ ਉਹ ਕਿਆ ਉਹਦਾ ਨਾਂ ਯਾਰ ਕਿਹੜਾ ਨਾ ਨਾ ਨਾ ਘੱਗਰ ਘੱਗਰ ਨਹੀਂ ਘੱਗਰ ਨਹੀਂ ਉਹ ਤਾਂ ਬਹੁਤ ਆਫ ਸੈਡ ਪੈਂਦਾ ਬਿਆਸ ਸਤਲੁਜ ਇੱਕ ਜਿਹਲਮ ਚਨਾਬ ਚਨਾਬ ਚਨਾਬ ਇਹ ਚਨਾਬ ਤਾਂ ਪਾਕਿਸਤਾਨ ਵਿੱਚ ਰਹਿੰਦਾ ਹਾਂ ਰਾਵੀ ਠੀਕ ਹੈ ਇਹ ਇੱਕ ਦਰਿਆ ਹੈ ਇਹ ਇੱਥੋਂ ਇੱਧਰਲੀ ਸਾਈਡ ਜਿਹੜਾ ਚੱਲਦਾ ਹੈ ਦੁਆਬੇ ਦੀ ਧਰਤੀ ਵਿੱਚ ਇੱਧਰ ਬਿਆਸ ਚੱਲਦਾ ਆਪਣਾ ਹਾਂਜੀ ਹਾਂ ਉਹ ਹੜ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਇੱਧਰਲੇ ਏਰੀਏ ਵਿੱਚ ਹੜ੍ਹ ਦੀ ਕੋਈ ਸਮੱਸਿਆ ਨਹੀਂ ਹੈ ਹਾਂ ਹਾਂ ਬਿਲਕੁਲ ਵਧੀਆ ਕਲਾਈਮੇਟ ਹੈ ਹਰਿਆਲੀ ਹੈ ਦੇਖਣ ਯੋਗ ਜਗ੍ਹਾ ਹੈ ਕਪੂਰਥਲਾ ਰੇਲ ਕੋਚ ਫੈਕਟਰੀ ਉੱਥੇ ਚੱਲਦੀ ਬੜੇ ਬੜੇ ਇੰਜਣ ਰੇਲ ਦੇ ਡੱਬੇ ਉੱਥੇ ਬਣ ਕੇ ਜਾਂਦੇ ਇਤਿਹਾਸਕ ਸ਼ਹਿਰ ਹੈ ਮਹਾਰਾਜ ਕਪੂਰ ਸਿੰਘ ਦੇ ਨਾਂ ਦੇ ਉੱਤੇ ਵਸਿਆ ਹੋਇਆ ਸ਼ਹਿਰ ਹੈ ਠੀਕ ਹੈ ਮਹਾਰਾਜ ਓਕੇ ਹੋਰ ਦੱਸ ਦਿਓ ਕਿਤੇ ਹੈਲਪ ਦੀ ਲੋੜ ਹੋਈ ਠੀਕ ਠੀਕ